ਨਹੀਂ ਮੈਨੂੰ ਪੰਜਾਬੀ ਬੋਲਣ ਜਾਂ ਲਿਖਣ ਵੇਲੇ ਤਾਂ ਕਦੇ ਕੋਈ ਮੁਸ਼ਕਿਲ ਨਹੀਂ ਆਈ ਪੰਜਾਬੀ ਬੋਲਣ ਵਿੱਚ ਲਿਖਣ ਵਿੱਚ ਮੈਨੂੰ ਬਹੁਤ ਹੀ ਜ਼ਿਆਦਾ ਸਹਿਜ ਮਹਿਸੂਸ ਹੁੰਦਾ ਵੈ ਇਹਦਾ ਮੇਨ ਰੀਜਨ ਆਹ ਵਾ ਕਿ ਮੈਨੂੰ ਇਹਦੇ 'ਚ ਕੋਈ ਦਿੱਕਤ ਨਹੀਂ ਆਉਂਦੀ ਕਿਉਂਕਿ ਮੈਂ ਜਦੋਂ ਤੋਂ ਜੰਮੀ ਹਾਂ ਮੈਂ ਪੰਜਾਬੀ ਬੋਲਦੀ ਵੀ ਹਾਂ ਪੰਜਾਬੀ ਪੜ੍ਹਦੀ ਪਈ ਹਾਂ ਇਹ ਸਾਡੀ ਮਾਤ ਭਾਸ਼ਾ ਹੈਗੀ ਹੈ ਅਤੇ ਜੇ ਸਾਨੂੰ ਸਾਡੀ ਮਾਤ ਭਾਸ਼ਾ 'ਚ ਹੀ ਸਹਿਜ ਮਹਿਸੂਸ ਨਹੀਂ ਹੁੰਦਾ ਤਾਂ ਫਿਰ ਕਿਹੜੀ ਹੋਰ ਭਾਸ਼ਾ 'ਚ ਮਹਿਸੂਸ ਹੋਵੇਗਾ ਇਹ ਤਾਂ ਸਾਡੀ ਭਾਸ਼ਾ ਵਾ ਇਹਦੇ 'ਚ ਤਾਂ ਸਾਨੂੰ ਹੋਵੇਗਾ ਹੀ ਹੋਵੇਗਾ ਨਾ